ਸਾਡੇ ਸਕੂਲ ਵਿੱਚ ਇੱਕ ਡਾਂਸ ਕੋਂਪੀਟੀਸ਼ਨ ਦਾ ਮੈਨੂੰ ਡਾਂਸ ਹੀ ਬਹੁਤ ਹੀ ਵਧੀਆ ਲਗਦਾ ਹੈ ਡਾਂਸ ਸਿੱਖਣ ਵਿਚ ਮੈਨੂੰ ਛੇ ਮਹੀਨੇ ਲੱਗ ਗਏ ਅਤੇ ਮੈ ਆਪਣੀ ਸਹੇਲੀ ਨੂੰ ਵੀ ਡਾਂਸ ਸਿਖਾ ਹੀ ਦਿੱਤਾ ਫਿਰ ਮੈਂ ਡਾਂਸ ਕੋਂਪੀਟੀਸ਼ਨ ਮੈਨੂੰ ਉੱਥੇ ਪੈਸੇ ਮਿਲੇ ਇਸ ਵਿੱਚ ਵੀ ਬਹੁਤ ਹੀ ਬਹੁਤ ਹੀ ਪੈਸੇ ਮਿਲਦੇ ਹਨ ਡਾਂਸ ਮੇਰਾ ਫੈਵਰੇਟ ਹੈ ਅਤੇ ਬਹੁਤ ਹੀ ਜ਼ਿਆਦਾ ਪੈਸੇ ਮਿਲਦੇ ਹਨ ਸਾਰੇ ਲੋਕ ਹੀ ਇਸ ਨੂੰ ਬਹੁਤ ਹੀ ਵਧੀਆ ਦੇਖਦੇ ਹਨ ਇਹਦੇ ਵਿਚ ਬਹੁਤ ਜ਼ਿਆਦਾ ਹੀ ਭੀੜ ਹੁੰਦੀ ਹੈ ਲੋਕਾਂ ਨੂੰ ਮੇਰਾ ਹੀ ਡਾਂਸ ਸੋਹਣਾ ਲੱਗਿਆ ਅਤੇ ਸਭ ਸਭ ਨੇ ਕਿਹਾ ਬਹੁਤ ਹੀ ਸੋਹਣਾ ਕੀਤਾ ਡਾਂਸ ਅਤੇ ਮੈਂ ਇੱਕ ਕੁੜੀ ਨੂੰ ਵੀ ਡਾਂਸ ਸਿਖਾਇਆ ਉਸਨੇ ਕਿਹਾ ਮੈਨੂੰ ਵੀ ਪੈਸੇ ਦਿਵਾ ਦੇ